ਸਤਿ ਸ਼੍ਰੀ ਅਕਾਲ ਭੂਆ ਜੀ ਵਧੀਆ ਤੁਸੀਂ ਸੁਣਾਓ ਠੀਕ ਹੋ ਕੁਛ ਨਹੀਂ ਬਸ ਵਿਹਲੇ ਸੀ ਹੋਰ ਘਰ ਸਭ ਠੀਕ ਨੇ ਅੱਛਾ ਮੈਂ ਇਹ ਸਲਾਹ ਕਰਨੀ ਸੀ ਤੁਹਾਡੇ ਨਾਲ ਮੈਂ ਕਿਹਾ ਸ਼ੂਟਿੰਗ ਦੇਖਣ ਚਲੀਏ ਸਰਹਿੰਦ ਫਿਲਮ ਦੀ ਸ਼ੂਟਿੰਗ ਹੋ ਰਹੀ ਆ ਹਾਂਜੀ ਪਤਾ ਤੁਹਾਨੂੰ ਪਤਾ ਹੀ ਹੈ ਘਰਦਿਆਂ ਨੇ ਮੈਨੂੰ ਇਕੱਲੀ ਨੂੰ ਜਾਣ ਨਹੀਂ ਦੇਣਾ ਹੈਗਾ ਤਾਂ ਕਰਕੇ ਮਖਾਂ ਚੱਲ ਭੂਆ ਜੀ ਨਾਲ ਸਲਾਹ ਕਰਦੀ ਹਾਂ ਕਿ ਇਕੱਠੇ ਚੱਲਦੇ ਹਾਂ ਬੋਲੀਵੁੱਡ ਦੀ ਫਿਲਮ ਹੈ ਹਾਂਜੀ ਕੱਲ੍ਹ ਨੂੰ ਜਾਣਾ ਆ ਆਪਾਂ ਸਵੇਰੇ ਨੌ ਕੁ ਵਜੇ ਨਾਲ ਉੱਥੇ ਸਲਮਾਨ ਖਾਨ ਨੇ ਆਉਣਾ ਹਾਂਜੀ ਕੱਲ੍ਹ ਨੌ ਕੁ ਵਜੇ ਨਾਲ ਚੱਲਦੇ ਹਾਂ ਹਾਂਜੀ ਉਹ ਤਾਂ ਹੈ ਟਾਈਮ ਨਾਲ ਤਿਆਰ ਹੋ ਜਾਂਗੇ ਉੱਦਾਂ ਨੌ ਕਿ ਦੀ ਐਂਟਰੀ ਹੈ ਅਤੇ ਫਿਰ ਕੇ ਥੋੜ੍ਹਾ ਜਿਹਾ ਉੱਠ ਕੇ ਤਿਆਰ ਹੋ ਜਾਂਗੇ ਫਿਰ ਟਾਈਮ ਨਾਲ ਚੱਲਾਂਗੇ ਘਰੋਂ ਹੀ ਉੱਥੇ ਲੱਗ ਜਾਣੇ ਆ ਤਿੰਨ ਚਾਰ ਕੁ ਘੰਟੇ ਲੱਗ ਜਾਣੇ ਆਪਣੇ ਖਾਣ ਪੀਣ ਨੂੰ ਉੱਥੇ ਤਾਂ ਮਿਲ ਜਾਣਗੀਆਂ ਚੀਜ਼ਾਂ ਵੈਸੇ ਉੱਥੇ ਥੋੜ੍ਹੇ ਮਹਿੰਗਾਈ ਹੁੰਦੀ ਆਪਾਂ ਕੁਝ ਆਪਣੇ ਨਾਲ ਲੈ ਜਾਂਗੇ ਹਾਂ ਘਰੋਂ ਜਿੱਦਾਂ ਟੋਸਟਰ ਵਗੈਰਾ ਆਪਾਂ ਬਣਾ ਕੇ ਲੈ ਜਾਂਗੇ ਹੈ ਨਾ ਹਾਂ ਉੱਥੇ ਤਾਂ ਥੋੜ੍ਹੀ ਜਿਹੀ ਮੰਹਿਗਾਈ ਆ ਹਾਂਜੀ ਹਾਂਜੀ ਹਾਂਜੀ ਸ਼ਾਮ ਤੱਕ ਤਾਂ ਪਹਿਲਾਂ ਹੀ ਆ ਜਾਣਾ ਆਪਾਂ ਹਾਂਜੀ ਹਾਂਜੀ ਕੋਈ ਨਹੀਂ ਟਾਇਮ ਨਾਲ ਹੀ ਆ ਜਾਣਾ ਕੈਬ ਬੁੱਕ ਕੀਤੀ ਆ ਉੱਤੇ ਜਾਣਾ ਜੀ ਹਾਂਜੀ ਹਾਂਜੀ ਠੀਕ ਹੈ ਫਿਰ ਮੈਨੂੰ ਸਲਾਹ ਕਰਕੇ ਘਰ ਦੱਸ ਦਿਓ ਫੋਨ ਕਰ ਦਿਓ ਬੈਕ ਕੋਲ ਕਰ ਦਿਓ ਠੀਕ ਆ ਜੀ ਠੀਕ ਆ ਹਾਂਜੀ ਸਭ ਠੀਕ ਠਾਕ ਆ ਤੁਸੀਂ ਸੁਣਾਓ ਠੀਕ ਹੈ ਓਕੇ